ਕਿਹਾ ਜਾਂਦਾ ਹੈ ਜਿੱਥੇ ਸਫਾਈ ਉੱਥੇ ਖੁਦਾਈ ਸਫਾਈ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਸਫਾਈ ਹੈ ਉਹ ਸਾਡੇ ਸਰੀਰ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਨੂੰ ਸਾਫ਼ ਰੱਖਣਾ ਚਾਹੀਦਾ ਆਪਣੇ ਨਹੁੰ ਨੂੰ ਆਪਣੇ ਵਾਲਾਂ ਨੂੰ ਆਪਣੇ ਕੱਪੜਿਆਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਉਸ ਤੋਂ ਬਾਅਦ ਘਰ ਦੀ ਸਫਾਈ ਦੀ ਗੱਲ ਆਉਂਦੀ ਹੈ ਤਾਂ ਆਪਣੇ ਘਰ ਦੇ ਵਿੱਚ ਛੋਟੇ ਮੋਟੇ ਕੀੜੇ ਮਕੌੜਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਵੀ ਆਪਾਂ ਨੂੰ ਆਪਣੇ ਘਰਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਆਪਣੀ ਰਸੋਈ ਨੂੰ ਸਾਫ਼ ਰੱਖਣਾ ਚਾਹੀਦਾ ਜੇਕਰ ਸਾਡੀਆਂ ਇਹ ਸਾਰੀਆਂ ਚੀਜ਼ਾਂ ਸਾਫ਼ ਨੇ ਪਰ ਸਾਡੇ ਆਲਾ ਦੁਆਲਾ ਸਾਫ਼ ਨਹੀਂ ਹੈ ਸਾਡੇ ਆਲੇ ਦੁਆਲੇ ਦਾ ਇਲਾਕਾ ਸਾਫ਼ ਨਹੀਂ ਹੈ ਤਾਂ ਇਸ ਸਫਾਈ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿਉਂਕਿ ਬਾਹਰ ਅਗਰ ਸਫਾਈ ਨਹੀਂ ਹੈ ਆਪਣੇ ਗਲੀ ਦੇ ਵਿੱਚ ਸਫਾਈ ਨਹੀਂ ਹੈ ਤਾਂ ਕਈ ਤਰ੍ਹਾਂ ਦੇ ਮੱਛਰ ਅਤੇ ਮੱਖੀਆਂ ਪੈਦਾ ਹੁੰਦੇ ਨੇ ਉਹ ਮੱਖੀਆਂ ਜਦੋਂ ਗੰਦਗੀ ਦੇ ਉੱਤੇ ਬੈਠ ਕੇ ਸਾਡੇ ਅੰਦਰ ਆਉਂਦੀਆਂ ਹਨ ਸਾਡੀ ਰਸੋਈ ਦੇ ਵਿੱਚ ਜਾਂਦੀਆਂ ਹਨ ਸਾਡੇ ਨੰਗੇ ਪਏ ਭੋਜਨ ਦੇ ਉੱਤੇ ਬੈਠਦੀਆਂ ਹਨ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਮੱਛਰਾਂ ਦੇ ਕੱਟਣ ਨਾਲ ਡੇਂਗੂ ਮਲੇਰੀਆ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ ਇਸ ਲਈ ਸਾਨੂੰ ਸਾਡੇ ਆਲੇ ਦੁਆਲੇ ਦੀ ਸਫਾਈ ਵੀ ਕਰਨਾ ਬੇਹਦ ਜ਼ਰੂਰੀ ਹੈ ਆਲੇ ਦੁਆਲੇ ਦੀ ਸਫਾਈ ਦੇ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸੁਥਰਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ ਆਪਣੀਆਂ ਗਲੀਆਂ ਨੂੰ ਆਪਣੀਆਂ ਨਾਲੀਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਗਲੀ ਦੇ ਵਿੱਚ ਕਦੇ ਵੀ ਕੂੜਾ ਕਰਕਟ ਇਸ ਤਰ੍ਹਾਂ ਨਹੀਂ ਸੁੱਟਣਾ ਚਾਹੀਦਾ ਕੂੜਾ ਕਰਕਟ ਨੂੰ ਹਮੇਸ਼ਾਂ ਕੂੜੇਦਾਨ ਦੇ ਵਿੱਚ ਪਾਓ ਨਾਲੀਆਂ ਨੂੰ ਹਮੇਸ਼ਾਂ ਢੱਕ ਕੇ ਰੱਖੋ ਗਲੀ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਪਾਣੀ ਨੂੰ ਖੜਾ ਨਾ ਰਹਿਣ ਦਿਓ ਕਿਉਂਕਿ ਜੇਕਰ ਪਾਣੀ ਖੜਾ ਹੁੰਦਾ ਤਾਂ ਕਈ ਤਰ੍ਹਾਂ ਦੀਆਂ ਮੱਛਰ ਅਤੇ ਮੱਖੀਆਂ ਜੋ ਨੇ ਉਹ ਪੈਦਾ ਹੁੰਦੇ ਨੇ ਜੋ ਕਿ ਇੱਕ ਬਿਮਾਰੀ ਦਾ ਘਰ ਨੇ ਇਹ ਦੇਖਣ ਨੂੰ ਵੀ ਸੁੰਦਰ ਨਹੀਂ ਲੱਗਦਾ ਇਸ ਲਈ ਸਾਨੂੰ ਕਦੇ ਵੀ ਹਮ ਸਫਾਈ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੇਕਰ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਸਾਨੂੰ ਇੱਕ ਵਧੀਆ ਜ਼ਿੰਦਗੀ ਦਾ ਅਹਿਸਾਸ ਹੋਵੇਗਾ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ ਇਸ ਲਈ ਹਮੇਸ਼ਾਂ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ